ਹਾਂਜੀ ਪੰਜਾਬੀ ਭਾਸ਼ਾ ਦੀ ਵਰਤੋਂ ਜੀ ਕਈ ਜਗ੍ਹਾ ਕੀਤੀ ਜਾਂਦੀ ਹੈ ਜੀ ਜਿਵੇਂ ਰੰਗ ਮੰਚ ਹੈ ਜੀ ਉਹਦੇ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਅਤੇ ਕਵਿਤਾਵਾਂ ਜਿਵੇਂ ਕਵਿਤਾਵਾਂ ਹੋਇਆ ਟੀਵੀ ਸ਼ੋਅ ਹੋਏ ਇਹਦੇ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਆਮ ਦਸਵੀਂ ਕਲਾਸ ਵਿੱਚ ਪੜ੍ਹਦੇ ਵਿੱਚ ਬੜੀਆਂ ਸੋਹਣੀਆਂ ਕਵਿਤਾਵਾਂ ਸਹੀ ਢੰਗ ਨਾਲ ਪੜ੍ਹਨ ਨੂੰ ਮਿਲਦਾ ਲੇਕਿਨ ਜਿਹੜੀਆਂ ਫਿਲਮਾਂ ਆਉਂਦੀਆਂ ਇਹਨਾਂ ਵਿੱਚ ਪੰਜਾਬੀ ਨੂੰ ਕਈ ਢੰਗ ਨਾਲ ਵਰਤਿਆ ਜਾਂਦਾ ਜਿਹਦੇ ਵਿੱਚੋਂ ਕੁਝ ਤਾਂ ਲਫਜ਼ ਠੀਕ ਰਹਿੰਦੇ ਨੇ ਕੁਝ ਸਮਝ ਨਹੀਂ ਆਉਂਦੇ ਇਹਦੇ ਵਿੱਚ ਕਈ ਲੁਟੱਕੀਵਾਜ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਹਦੇ ਵਿੱਚ ਪੰਜਾਬੀ ਨੂੰ ਪੰਜਾਬੀ ਨਹੀਂ ਦਿਖਦੀ ਕਿ ਹੋਰ ਆਪਣਾ ਹੀ ਉਹਨਾਂ ਨੇ ਲੈਣਾ ਲਾਈਆਂ ਹੁੰਦੀਆਂ ਜੀ ਜੇ ਵਿੱਚੋਂ ਪੰਜਾਬੀ ਫਿਲਮਾਂ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਮਜ਼ਾਕੀਆ ਚੁਟਕਲੇ ਵਗੈਰਾ ਸੁਣਾਏ ਜਾਂਦੇ ਨੇ ਇਸ ਢੰਗ ਨਾਲ ਜਿਹੜੀ ਸ਼ਿਕਸ਼ਾ ਉਹਦੇ ਵਿੱਚ ਹੀ ਠੀਕ ਹੈ ਬਾਕੀ ਫਿਲਮਾਂ ਹੋਈਆਂ ਰੰਗ ਮੰਚ ਗੀਤਾਂ ਕਵਿਤਾਵਾਂ ਟੀਵੀ ਸ਼ੋਅ ਵਿੱਚ ਜਿਹੜਾ ਵੀ ਇਸਤੇਮਾਲ ਕੀਤਾ ਜਾਂਦਾ ਇਹ ਕੋਈ ਸਹੀ ਪੰਜਾਬੀ ਨਹੀਂ ਹੁੰਦੀ ਅਤੇ ਜਿਹੜੀ ਬੋਲੀ ਜਾਏ ਹਾਂਜੀ ਠੀਕ ਹੈ ਜੀ